ਹਾਂਜੀ ਭਾਰਤ ਵਿੱਚ ਚਾਹ ਪਸੰਦ ਹੈ ਜੀ ਲੋਕਾਂ ਨੂੰ ਅਤੇ ਅਸੀਂ ਵੀ ਆਪਣੇ ਘਰਾਂ 'ਚ ਬਣਾਉਣੇ ਹਾਂ ਜੀ ਚਾਹ ਜਿਵੇਂ ਕਿ ਪਹਿਲਾਂ ਅਸੀਂ ਪਾਣੀ ਪਾਉਂਦੇ ਹਾਂ ਜੀ ਉਹਦੇ 'ਚ ਪੱਤੇ ਪਾ ਕੇ ਮਿੱਠਾ ਪਾ ਕੇ ਜੀ ਬਸ ਫਿਰ ਉਬਾਲੀ ਦੇ ਕੇ ਦੁੱਧ ਪਾ ਦਿੰਦੇ ਹਾਂ ਜੀ ਉਹ ਚਾਹ ਬਣ ਜਾਂਦੀ ਹੈ ਅਤੇ ਬਸ ਫਿਰ ਅਸੀਂ ਪੀ ਲੈਂਦੇ ਹਾਂ ਜੀ ਆਹੀ ਹੈ ਜੀ ਧੰਨਵਾਦ ਜੀ